ਸਤਿ ਸ਼੍ਰੀ ਅਕਾਲ ਜੀ ਅਸੀਂ ਜੈਨ ਰੈਸਟੋਰੈਂਟ ਤੋਂ ਬਾ ਦੁਆਰਾ ਜੈਨ ਰੈਸਟੋਰੈਂਟ ਤੋਂ ਅਸੀਂ ਗੱਲ ਕਰ ਰਹੇ ਹਾਂ ਅਸੀਂ ਤੁਹਾਡੇ ਤੋਂ ਜਾਣਕਾਰੀ ਲੈਣਾ ਚਾਹੁੰਦੇ ਹਾਂ ਕੀ ਤੁਹਾਡੇ ਮੈਨਿਊ ਵਿੱਚ ਕੋਈ ਨਵਾਂ ਫੂਡ ਅੱਜ ਲਈ ਕੋਈ ਨਵਾਂ ਫੂਡ ਤਿਆਰ ਹੋਇਆ ਜਿਹਦੇ ਲਈ ਅਸੀਂ ਤੁਹਾਨੂੰ ਔਡਰ ਕਰ ਸਕੀਏ ਵੈਸੇ ਤੁਹਾਡਾ ਫੂਡ ਬਹੁਤ ਜ਼ਿਆਦਾ ਵਧੀਆ ਹੁੰਦਾ ਅਤੇ ਸਾਡੇ ਬਜਟ ਵਿੱਚ ਵੀ ਹੋਵੇ ਤੁਸੀਂ ਮੈਨੂੰ ਅੱਜ ਦੱਸ ਸਕਦੇ ਹੋ ਤੁਹਾਡੇ ਫੂਡ ਵਿੱਚ ਕੋਈ ਨਿਊ ਅ ਆਈਟਮ ਤਿਆਰ ਹੋਈ ਹੈ ਜੋ ਅਸੀਂ ਤੁਹਾਨੂੰ ਔਡਰ ਕਰ ਸਕੀਏ